ਹਸਬੈਡ ਨੂੰ ਨਾ ਪਤਾ ਨਹੀਂ ਕੀ ਨਾ ਹੈ ਇੰਨਾਂ ਹੈ ਕਰੇਜ਼ ਹੈ ਆਨਲਾਇਨ ਚੀਜ਼ਾਂ ਮੰਗਵਾਉਣ ਦਾ ਕਿ ਇਨ੍ਹਾਂ ਨੇ ਨਾ ਆਨਲਾਈਨ ਸਪਰਾਉਟਸ ਵਾਲੀ ਨਾ ਜਿਹੜੀ ਜਿਹਦੇ 'ਚ ਉਹ ਬਣਦੇ ਆ ਹੈ ਨਾ ਉਹ ਮੰਗਵਾ ਲਈ ਠੀਕ ਹੈ ਆਨਲਾਇਨ ਅਤੇ ਬੜਾ ਜਦੋਂ ਆਈ ਦੇਖਣ ਨੂੰ ਤਾਂ ਬੜੀ ਵਧੀਆ ਲੱਗਦੀ ਸੀਗੀ ਕਿ ਬੜੇ ਉਹਦੇ ਦੋ ਤਿੰਨ ਲੇਅਰ ਬਣਿਆ ਹੋਈਆਂ ਸੀਗੀਆਂ ਬੋਕਸਿਜ਼ ਸੀਗੇ ਕਿ ਲੱਗਦਾ ਸੀਗਾ ਕਿ ਇਹਦੇ 'ਚ ਅਲੱਗ ਅਲੱਗ ਜਦੋਂ ਅਸੀਂ ਪਾਵਾਂਗੇ ਆਪਣਾ ਹੈ ਨਾ ਕਿ ਕਾਫ਼ੀ ਅੱਛੇ ਸਪਰਾਉਟਸ ਆ ਜਿਹੜੇ ਉਹ ਬਣਨਗੇ ਬਟ ਉਹਨੂੰ ਜਦੋਂ ਯੂਸ ਕੀਤਾ ਇੱਕ ਦਿਨ ਦੇਖਿਆ ਉਹਦਾ ਤਾਂ ਕੁਛ ਵੀ ਨਹੀਂ ਬਣਿਆ ਦੂਜੇ ਦਿਨ ਦੇਖਿਆ ਕੁਛ ਵੀ ਨਹੀਂ ਤੀਜੇ ਦਿਨ ਵੀ ਦੇਖਿਆ ਕੁਛ ਨਹੀਂ ਜਦੋ ਫ਼ਸਟ ਉਹਦੀ ਲੇਅਰ 'ਤੇ ਪਾਣੀ ਪਾਉਂਦੇ ਸੀਗੇ ਬਸ ਉਹ ਐਂਵੇ ਹੀ ਨੀਚੇ ਤੱਕ ਆ ਜਾਂਦਾ ਸੀਗਾ ਬਟ ਉਹਨਾਂ ਨੂੰ ਕੋਈ ਮਤਲਬ ਪਾਣੀ ਨਹੀਂ ਮਿਲਿਆ ਹੈਗਾ ਜਿਹਦੇ ਵਿੱਚ ਆਪਣਾ ਅਸੀਂ ਸਮਾਨ ਪਾਇਆ ਹੋਇਆ ਸੀਗਾ ਅਤੇ ਕਾਫ਼ੀ ਦਿਨ ਇਹ ਦੇਖਿਆ ਉਸ ਤੋਂ ਬਾਅਦ ਤਾਂ ਫਿਰ ਉਹ ਮੇ ਮਟੀਰੀਅਲ ਸੀ ਜਿਹੜਾ ਵੇਸਟ ਹੋ ਗਿਆ ਸਾਰਾ ਅਤੇ ਉਹ ਸੁੱਟ ਤਾ ਅੱਜ ਉਹ ਆਏ ਨੂੰ ਆਨਲਾਈਨ ਸਮਾਨ ਮੈਨੂੰ ਲੱਗਦਾ ਕਿ ਪੰਜ ਛੇ ਮਹੀਨੇ ਹੋ ਗਏ ਅਤੇ ਉਹ ਕੀ ਹੈ ਜੀ ਇੱਕ ਕਬਾੜ ਬਣ ਚੁੱਕਿਆ ਹੈ ਠੀਕ ਹੈ ਆਨਲਾਈਨ ਦਿਖਾਉਂਦੇ ਬੜਾ ਵਧੀਆ ਹੈ ਦੇਖਣ ਨੂੰ ਲੱਗਦਾ ਏ ਕਿ ਨਹੀਂ ਜੀ ਇਹ ਬਹੁਤ ਵਧੀਆ ਹੈ ਪਰ ਮੇਰਾ ਜਿਹੜਾ ਐਕਸਪੀਰੀਅਸ ਰਿਹਾ ਉਹ ਬੜਾ ਗੰਦਾ ਰਿਹਾ ਅਤੇ ਮੈਂ ਤਾਂ ਇਹ ਚੀਜ਼ਾਂ 'ਤੇ ਕੋਈ ਵਿਸ਼ਵਾਸ ਨਹੀਂ ਕਰਦੀ ਮੈਨੂੰ ਤਾਂ ਇਹ ਆ ਕਿ ਆਨਲਾਈਨ ਨਾ ਲਉ ਤੁਸੀਂ ਸ਼ੌਪ 'ਤੇ ਜਾਉ ਉੱਥੇ ਸਾਹਮਣੇ ਚੀਜ਼ ਦੇਖੋ ਅਤੇ ਫਿਰ ਖਰੀਦੋ ਆਨਲਾਈਨ ਚੀਜ਼ਾਂ ਤੋਂ ਤਾਂ ਮੈਂ ਗੁਰੇਜ਼ ਹੀ ਕਰਦੀ ਹਾਂ